ਹਾਂਜੀ ਮੈਂ ਇਸ ਐਪ ਦੀ ਵਰਤੋਂ ਕਰਦੀ ਹਾਂ ਇਸ ਘੜੀ ਨੂੰ ਪਾਉਣ ਨਾਲ ਮੈਨੂੰ ਬਹੁਤ ਫਾਇਦਾ ਹੁੰਦਾ ਨੇ ਮੇਰੇ ਵੱਧ ਰਹੇ ਬੀ ਪੀ ਬਾਰੇ ਮੈਨੂੰ ਪਤਾ ਚੱਲ ਜਾਂਦਾ ਹੈ ਅਤੇ ਘੱਟ ਰਹੇ ਬੀ ਪੀ ਬਾਰੇ ਵੀ ਮੈਨੂੰ ਪਤਾ ਚੱਲਦਾ ਹੈ ਇਸ ਨਾਲ ਮੈਂ ਬਹੁਤ ਸਹਿਮਤ ਹਾਂ ਅਤੇ ਮੈਂ ਸਵੇਰੇ ਜਦ ਵੀ ਜੋਗਿੰਗ ਕਰਨ ਜਾਂਦੀ ਹਾਂ ਤਾਂ ਮੈਂ ਇਹ ਘੜੀ ਨੂੰ ਪਾ ਕੇ ਜਾਂਦੀ ਹਾਂ ਇਸ ਨਾਲ ਮੈਂ ਕਿੰਨੇ ਕਦਮ ਚੱਲੀ ਹਾਂ ਅਤੇ ਕਿੰਨੇ ਕਦਮ ਰੁਕੀ ਹਾਂ ਅਤੇ ਕਿੰਨਾ ਮੇਰਾ ਬੀ ਪੀ ਨੇ ਮੇਰੀ ਕਿੰਨੀ ਧੜਕਣ ਤੇਜ਼ ਨੇ ਜਾਂ ਘੱਟ ਨੇ ਮੈਨੂੰ ਸਭ ਪਤਾ ਚੱਲ ਜਾਂਦਾ ਨੇ ਅਤੇ ਮੈਂ ਉਸ ਤਰ੍ਹਾਂ ਆਪਦਾ ਟਰੀਟਮੈਂਟ ਕਰਵਾਉਂਦੀ ਹਾਂ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੀ ਸਿਹਤ ਦਾ ਬੜਾ ਧਿਆਨ ਰੱਖਦੀ ਹਾਂ ਹੋਰ ਮੈਂ ਇਸ ਐਪ ਦੇ ਪ੍ਰਤੀ ਸਹਿਮਤ ਹਾਂ ਮੈਂ ਜਦ ਵੀ ਬਾਹਰ ਘੁੰਮਣ ਜਾਂਦੀ ਹਾਂ ਤਾਂ ਮੈਂ ਘੜੀ ਨੂੰ ਪਾ ਕੇ ਜਾਂਦੀ ਹਾਂ ਔਰ ਮੈਨੂੰ ਇਸ ਦੇ ਨਾਲ ਪਤਾ ਚੱਲ ਜਾਂਦਾ ਹੈ ਮੇਰਾ ਬੀ ਪੀ ਕਿਤੇ ਹਾਈ ਤਾਂ ਨਹੀਂ ਹੈ ਇਸ ਐਪ ਦੀ ਵਰਤੋਂ ਤੋਂ ਮੈਂ ਸਹਿਮਤ ਹਾਂ ਇੱਕ ਵਾਰੀ ਮੈਂ ਸੁਣਿਆ ਨੇ ਅਮੇਰੀਕਾ ਦੇ ਇੱਕ ਬਜ਼ੁਰਗ ਨੂੰ ਕੋਈ ਇੱਦਾਂ ਹੀ ਪ੍ਰੋਬਲਮ ਹੋ ਰਹੀ ਸੀ ਕਿ ਉਸ ਨੂੰ ਧੜਕਣ ਤੇਜ਼ ਲੱਗ ਰਹੀ ਸੀ ਅਤੇ ਉਹਨੂੰ ਅਜੀਬ ਜਿਹਾ ਫੀਲ ਹੋ ਰਿਹਾ ਸੀ ਅਤੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਹੈ ਕਿ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਨੇ ਕਿ ਮੇਰੀ ਧੜਕਣ ਤਾਂ ਨਹੀਂ ਕਿਤੇ ਤੇਜ਼ ਆਪਾਂ ਡਾਕਟਰ ਦੇ ਨਾਲ ਸੰਪਰਕ ਕਰਕੇ ਹੁਣੇ ਹੀ ਦਵਾਈ ਲੈਣ ਚੱਲੀਏ ਅਤੇ ਉਹ ਜਦ ਡਾਕਟਰ ਕੋਲ ਗਏ ਤਾਂ ਉਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੀ ਧੜਕਣ ਬਹੁਤ ਤੇਜ਼ ਹੈ ਅਤੇ ਇਹਨਾਂ ਨੂੰ ਅਟੈਕ ਆਉਣ ਵਾਲਾ ਨੇ ਜਦ ਡਾਕਟਰ ਨੇ ਇਹਨਾਂ ਦਾ ਬੀ ਪੀ ਚੈੱਕ ਕਰਕੇ ਤਾਂ ਇਹਨਾਂ ਦਾ ਟਰੀਟਮੈਂਟ ਸ਼ੁਰੂ ਕੀਤਾ ਅਤੇ ਇਸ ਨਾਲ ਉਸ ਆਦਮੀ ਦੀ ਜਾਨ ਬਚ ਗਈ